ਹੈਲੋ ਸਤਿ ਸ਼੍ਰੀ ਅਕਾਲ ਜੀ ਤੁਸੀਂ ਰਸੋਈ ਰੈਸਟੋਰੈਂਟ ਤੋਂ ਬੋਲਦੇ ਹੋ ਮੈਂ ਮਹਿਕ ਬੋਲਦੀ ਹਾਂ ਤੁਹਾਡਾ ਅੱਜ ਆਡਰ ਬਹੁਤ ਜ਼ਿਆਦਾ ਲੇਟ ਹੋ ਗਿਆ ਮੈਂ ਪਹਿਲਾਂ ਵੀ ਤੁਹਾਡੇ ਤੋਂ ਹੀ ਮੰਗਵਾਉਦੀ ਹਾਂ ਬਟ ਕਦੇ ਇੱਦਾਂ ਦੀ ਕੋਈ ਪ੍ਰੋਬਲਮ ਆਈ ਨਹੀਂ ਹੁਣ ਇਹ ਪਹਿਲੀ ਵਾਰੀ ਪ੍ਰੋਬਲਮ ਆਈ ਆ ਮੈਨੂੰ ਤੁਹਾਡੇ ਰੈਸਟੋਰੈਂਟ ਦਾ ਹਰ ਇੱਕ ਚੀਜ਼ ਬਹੁਤ ਵਧੀਆ ਲੱਗਦੀ ਆ ਕਿਉਂਕਿ ਉਹ ਟੇਸਟੀ ਬਣਿਆ ਹੁੰਦਾ ਹੈ ਇਹ ਤੁਸੀਂ ਜ਼ਿਆਦਾਤਰ ਔਰਗੈਨਿਕ ਸਬਜ਼ੀਆਂ ਯੂਜ਼ ਕਰਦੇ ਹੋ ਕੋਈ ਮਿਲਾਵਟ ਵਗੈਰਾ ਨਹੀਂ ਯੂਜ਼ ਕਰਦੇ ਹ ਹਰੇਕ ਚੀਜ਼ ਵਿੱਚ ਹੀ ਤੁਹਾਡਾ ਵਧੀਆ ਤਰੀਕੇ ਨਾਲ ਤਿਆਰ ਕੀਤੇ ਹੁੰਦੇ ਆ ਜਦੋਂ ਵੀ ਉਸ ਨੂੰ ਖਾਂਦੇ ਹਾਂ ਤਾਂ ਪੂਰਾ ਵਧੀਆ ਲੱਗਦਾ ਹੈਗਾ ਤਾਂ ਅੱਜ ਬਹੁਤ ਜ਼ਿਆਦਾ ਲੇਟ ਹੋ ਗਿਆ ਅੱਜ ਸਾਡੇ ਘਰ ਵਿੱਚ ਗੈਸਟ ਆਏ ਬੈਠੇ ਨੇ ਅੱਗੇ ਅਸੀਂ ਉਹਨਾਂ ਨੂੰ ਖਵਾਉਣਾ ਹੈਗਾ ਅਤੇ ਤੁਸੀਂ ਹਜੇ ਤੱਕ ਸਾਡਾ ਕੋਈ ਆਡਰ ਭੇਜਿਆ ਨਹੀਂ ਤੁਹਾਡਾ ਕਸਟਮ ਡਿਲੀਵਰੀ ਮੈਨ ਕਿੱਥੇ ਰਹਿ ਗਿਆ ਹੈ ਸਾਡੇ ਗੈਸਟ ਵੇਟ ਕਰ ਰਹੇ ਹੈ ਕਿ ਕਦੋਂ ਆਡਰ ਆਏਗਾ ਅਤੇ ਕਦੋਂ ਅਸੀਂ ਇਹਨਾਂ ਦਾ ਟੇਸਟ ਚੱਖਾਂਗੇ ਅਤੇ ਅਸੀਂ ਵੀ ਅਗਾਂਹ ਜੇ ਸਾਨੂੰ ਕੋਈ ਪਸੰਦ ਆਇਆ ਤਾਂ ਕਹਿੰਦੇ ਅਸੀਂ ਅੱਗੇ ਤੋਂ ਅੱਗੇ ਆਡਰ ਕਰਾਂਗੇ ਮੈਨੂੰ ਤੁਹਾਡੇ ਜ਼ਿਆਦਾਤਰ ਇਹ ਹੀ ਚੀਜ਼ ਪਸੰਦ ਸੀ ਕਿ ਤੁਹਾਡੇ ਆਡਰ ਕਦੇ ਲੇਟ ਨਹੀਂ ਹੋਏ ਬਟ ਮੇਰੀ ਆਸ 'ਤੇ ਪਹਿਲੀ ਵਾਰ ਹੋਇਆ ਕਿ ਤੁਹਾਡਾ ਆਡਰ ਬਹੁਤ ਜ਼ਿਆਦਾ ਲੇਟ ਹੋ ਗਿਆ ਹੈ ਤਾਂ ਪਲੀਜ਼ ਆਪਣੇ ਡਿਲੀਵਰੀ ਮੈਨ ਨੂੰ ਫੋਨ ਕਰੋ ਜਾਂ ਕੁਛ ਵੀ ਕਰੋ ਮੈਸੇਜ ਲਗਾਓ ਸਾਡਾ ਔਡਰ ਔਡਰ ਜਲਦੀ ਤੋਂ ਜਲਦੀ ਭੇਜੋ ਤਾਂ ਕਿ ਸਾਡੇ ਗੈਸਟ ਵੇਟ ਨਾ ਕਰਨ ਅਤੇ ਉਹਨਾਂ ਨੂੰ ਵੀ ਇਹ ਖਾਣਾ ਬਹੁਤ ਜ਼ਿਆਦਾ ਪਸੰਦ ਆਵੇ ਜੇ ਉਹਨਾਂ ਨੂੰ ਇਹ ਖਾਣਾ ਪਸੰਦ ਆਇਆ ਤਾਂ ਉਹ ਵੀ ਕਹਿੰਦੇ ਨੇ ਕਿ ਅਸੀਂ ਵੀ ਅੱਗੇ ਤੋਂ ਇਹਨਾਂ ਤੋਂ ਹੀ ਆਡਰ ਕਰਿਆ ਕਰਾਂਗੇ ਬਾਕੀ ਤੁਸੀਂ ਜਲਦੀ ਤੋਂ ਜਲਦੀ ਮੇਰਾ ਔਡਰ ਭੇਜਣ ਦੀ ਕੋਸ਼ਿਸ਼ ਕਰੋ ਤਾਂ ਕਿ ਉਹਨਾਂ ਨੂੰ ਵੀ ਵੇਟ ਨਾ ਕਰਨੀ ਪਵੇ